ਪੰਜਾਬ ਵਿੱਚ ਖਾਸ ਕਰਕੇ ਦੋ ਪ੍ਰਮੁੱਖ ਫਸਲਾਂ ਹੀ ਹੁੰਦੀਆਂ ਹਨ ਕਣਕ ਅਤੇ ਝੋਨਾ ਇਸ ਤੋਂ ਇਲਾਵਾ ਪੁਰਾਣੇ ਸਮੇਂ ਵਿੱਚ ਜਵਾਰ ਗੰਨਾ ਮੱਕੀ ਆਦਿ ਦੀ ਬਿਜਾਈ ਵੀ ਕੀਤੀ ਜਾਂਦੀ ਸੀ ਪਸ਼ੂਆਂ ਵਿੱਚ ਆਮ ਤੌਰ 'ਤੇ ਘਰਾਂ ਵਿੱਚ ਮੱਝਾਂ ਦਾ ਹੀ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਦੁੱਧ ਕਿਉੰਕਿ ਉਹਨਾਂ ਦਾ ਦੁੱਧ ਜਿਆਦਾ ਗਾੜ੍ਹਾ ਹੁੰਦਾ ਹੈ ਇਸ ਤੋਂ ਇਲਾਵਾ ਗਊਆਂ ਦਾ ਵੀ ਹੁੰਦਾ ਹੈ ਕਿਉਂਕਿ ਉਹਨ ਉਹਨਾਂ ਦਾ ਦੁੱਧ ਕਾਫ਼ੀ ਪਤਲਾ ਹੁੰਦਾ ਹੈ ਅਤੇ ਇਸ ਤੋਂ ਇਲਾਵਾ ਪੋਲਟਰੀ ਫਾਰਮ ਜਾਂ ਮੱਛੀ ਪਾਲਣ ਦਾ ਕਾਰੋਬਾਰ ਵੀ ਕਿਸਾਨ ਕਰਦੇ ਹਨ ਅਤੇ ਇਸ ਨਾਲ ਵੀ ਉਹਨਾਂ ਨੂੰ ਆਮਦਨ ਪ੍ਰਾਪਤ ਹੁੰਦੀ ਹੈ